ਅਸੀਂ ਜ਼ਿਆਦਾਤਰ ਬਾਗਬਾਨੀ ਵਿਹੜੇ ਵਿੱਚ ਕਰਦੇ ਹਾਂ ਸਾਡੇ ਘਰ ਦੇ ਵਿੱਚ ਕੱਚਾ ਮੈਦਾਨ ਹੈ ਅਤੇ ਉਸਦੇ ਵਿੱਚ ਅਸੀਂ ਜ਼ਿਆਦਾਤਰ ਬਾਗਬਾਨੀ ਕਰਦੇ ਹਾਂ ਜਿਹੜੇ ਕਿ ਫੁੱਲ ਜਾਂ ਪੌਦੇ ਜ਼ਿਆਦਾ ਵੱਡੇ ਹੁੰਦੇ ਹਨ ਉਹਨਾਂ ਨੂੰ ਅਸੀਂ ਵਿਹੜੇ ਦੇ ਵਿੱਚ ਲਗਾਉਂਦੇ ਹਾਂ ਅਤੇ ਜਿਹੜੇ ਕਿ ਪੌਦੇ ਛੋਟੇ ਹੋਣ ਉਹਨਾਂ ਨੂੰ ਅਸੀਂ ਜ਼ਿਆਦਾਤਰ ਗਮਲੇ ਦੇ ਵਿੱਚ ਲਗਾ ਦਿੰਦੇ ਹਾਂ ਅਤੇ ਕੁਝ ਕੁ ਜਿਹਨਾਂ ਨੂੰ ਜ਼ਿਆਦਾ ਧੁੱਪ ਦੀ ਲੋੜ ਪੈਂਦੀ ਆ ਉਹਨਾਂ ਨੂੰ ਗਮਲਿਆਂ ਵਿੱਚ ਪਾ ਕੇ ਛੱਤ ਦੇ ਉੱਤੇ ਰੱਖ ਆਨੇ ਹਾਂ ਤਾਂ ਕਿ ਉਹਨਾਂ ਨੂੰ ਲੋੜੀਂਦਾ ਧੁੱਪ ਅਤੇ ਹਵਾ ਮਿਲਦੀ ਰਹੇ